ਹੈਲੋ ਕਿਵੇਂ ਹੋ ਤੁਸੀਂ ਵਧੀਆ ਹੋਰ ਘਰ ਠੀਕ ਨੇ ਸਭ

ਹਾਂਜੀ ਮੈਨੂੰ ਪਤਾ ਇੱਥੇ ਨਵਾਂ ਕੋਚਿੰਗ ਸੈਂਟਰ ਖੁੱਲ੍ਹਿਆ ਔਰ ਨਾ ਮੈਨੂੰ ਇਹ ਥੋੜ੍ਹੀ ਦਿੱਕਤ ਆਉਂਦੀ ਪਈ ਆ ਕਿ ਮੈਂ ਕਿਹੜੇ ਕੋਚਿੰਗ ਸੈਂਟਰ 'ਤੇ ਜੁਆਇਨ ਕਰਾਂ ਵਾਧੂ ਕੋਚਿੰਗ ਸੈਂਟਰ ਨੇ ਅਤੇ ਮੈਨੂੰ ਇਹੋ ਜਿਹਾ ਕੋਈ ਕੋਚਿੰਗ ਸੈਂਟਰ ਚਾਹੀਦਾ ਜਿਹੜਾ ਮੈਨੂੰ ਆਨਲਾਈਨ ਅਤੇ ਔਫਲਾਈਨ ਦੋਵੇਂ ਬੈਚ ਮਤਲਬ ਪ੍ਰਵਾਇਡ ਹੋਣ ਮਤਲਬ ਤਾਂਕਿ ਮੈਂ ਵਧੀਆ ਆਰਾਮ ਨਾਲ ਵੀ ਕਰ ਸਕਾਂ ਉੱਥੇ ਵੀ ਪੜ੍ਹ ਸਕਾਂ ਅਤੇ ਆਨਲਾਈਨ ਵੀ ਪੜ੍ਹ ਸਕਾਂ ਆਰਾਮ ਨਾਲ ਘਰ ਬੈਠੇ ਵੀ ਹਾਂ ਮੈਂ ਡਰੀਮ ਇੰਸਟੀਚਿਊਟ ਵੇਖਾਂਗੀ ਕਿਉਂਕਿ ਇਹਨਾਂ ਦੇ ਨਾ ਰਿਵਿਊ ਵਧੀਆ ਨੇ ਅਤੇ ਵਾਧੂ ਲੱਗੇ ਹੋਏ ਨੇ ਬੱਚੇ ਇਹਨਾਂ ਦੇ ਅਤੇ ਮੈਂ ਆਪ ਪਹਿਲੇ ਵੀ ਇੱਥੋਂ ਕੋਚਿੰਗ ਲਿੱਤੀ ਸੀ ਅਤੇ ਹੁਣ ਵੀ ਹਾਂ ਜਿਹੜਾ ਨਵਾਂ ਖੁੱਲ੍ਹਾ ਨਾ ਉਹਦਾ ਤਾਂ ਮੈਨੂੰ ਪਤਾ ਨਹੀਂ ਪਰ ਮੈਂ ਉਹਦੇ ਤੋਂ ਲਿੱਤੀ ਹੋਈ ਆ ਅਤੇ ਹੁਣ ਵੀ ਮੈਂ ਉੱਥੋਂ ਹੀ ਸੋਚ ਰਹੀ ਹਾਂ ਕਿਉਂਕਿ ਵਧੀਆ ਸੀ ਮੇਰਾ ਪਹਿਲੇ ਵੀ ਰਿਜ਼ਲਟ ਹਾਂਜੀ ਤੂੰ ਕਿੱਥੋਂ ਲੈਣੀ ਆ ਵੈਸੇ ਨਾ ਤੂੰ ਓਲ ਇਗ੍ਜ਼ੈਮ ਦੀ ਨਾ ਬਠਿੰਡਾ ਤੋਂ ਲੈ ਉਹ ਵਧੀਆ ਉੱਥੇ ਜਿਥੇ ਤੂੰ ਈ ਟੀ ਟੀ ਦੀ ਲੈਣੀ ਆ ਤਾਂ ਤੂੰ ਫਿਰ ਇੱਥੋਂ ਫਾਜ਼ਿਲਕਾ ਵੇਖ ਡਰੀਮ ਇੰਸਟੀਚਿਊਟ ਤੋਂ ਵਧੀਆ ਆ ਕੋਈ ਦਿੱਕਤ ਨਹੀਂ ਹੈਗੀ ਅਤੇ ਇਹਨਾਂ ਦੇ ਰਿਜਲਟ ਵੀ ਬਹੁਤ ਵਧੀਆ ਉਹਨਾਂ ਨੇ ਬਹੁਤ ਬੱਚੇ ਲੱਗੇ ਨੇ ਇਹਨਾਂ ਦੇ ਹੁਣ ਵੀ ਅਤੇ ਪਿਛਲੇ ਵਾਰੀ ਵੀ ਬਹੁਤ ਲੱਗੇ ਸੀ ਹਾਂ ਹਾਂ ਸਟਾਫ਼ ਵੀ ਵਧੀਆ ਅਤੇ ਕੰਮ ਵੀ ਬਹੁਤ ਵਧੀਆ ਅਤੇ ਅਤੇ ਆਨਲਾਈਨ ਵੀ ਦਿੰਦੇ ਨੇ ਅਤੇ ਆਫਲਾਈਨ ਵੀ ਦਿੰਦੇ ਨੇ ਹਾਂ ਅਤੇ ਜਿਹੜੀ ਚੀਜ਼ਾਂ ਆਫਲਾਈਨ 'ਚ ਰਹਿ ਜਾਂਦੀਆਂ ਨੇ ਕਈ ਵਾਰੀ ਸਮਝ ਨਹੀਂ ਲੱਗਦੀ ਉਹ ਅਸੀਂ ਆਨਲਾਈਨ 'ਚ ਦੁਬਾਰਾ ਵੇਖ ਸਕਦੇ ਹਾਂ ਇਹੀ ਜਿਹੀ ਕੋਈ ਦਿੱਕਤ ਨਹੀਂ ਹੈਗੀ ਉਹਦੇ ਵਿੱਚ ਹਾਂ ਹਾਂ ਰਿਕਾਰਡਿਡ ਫੈਸ਼ਨ ਵੀ ਹੈ ਚੱਲ ਫਿਰ ਵੇਖ ਲਈ ਤੂੰ ਤਾਂ ਮੈਂ ਤਾਂ ਡਰੀਮ ਇੰਸਟੀਚਿਊਟ ਤੋਂ ਹੀ ਸੋਚਾਂਗੀ ਤੂੰ ਵੇਖ ਲਈ ਫਿਰ ਕਿੱਥੋਂ ਲੈਣੀ ਆ ਵੈਸੇ ਤੂੰ ਬਠਿੰਡਾ ਤੋਂ ਲਈ ਤਾਂ ਵਧੀਆ ਹੈ ਚੱਲ ਫਿਰ ਠੀਕ ਹੈ ਠੀਕ ਹੈ ਬਾਏ